ਹਾਂਜੀ ਸਾਡੇ ਕੋਲ ਆਪ ਦੇ ਨਿੱਜੀ ਟੀਚੇ ਹਨ ਜਿਵੇਂ ਕਿ ਹਰ ਬੰਦੇ ਨੇ ਆਪਣੀ ਜ਼ਿੰਦਗੀ ਨੂੰ ਬਿਹਤਰ ਢੰਗ ਨਾਲ ਜਿਉਣ ਦੇ ਲਈ ਇੱਕ ਟੀਚਾ ਮਿਥਿਆ ਹੁੰਦਾ ਹੈ ਇਵੇਂ ਹੀ ਮੈਂ ਇੱਕ ਟੀਚਾ ਮਿਥਿਆ ਏ ਕਿ ਮੈਂ ਸਟੂਡੈਂਟ ਹਾਂ ਸਟੂਡੈਂਟ ਅਤੇ ਸਟੱਡੀ ਕਰਦਾ ਕੋਂਪੀਟੇਟੀਵ ਐਗਜ਼ਾਮ ਦੀ ਜਿਵੇਂ ਕਿ ਸਰਕਾਰੀ ਨੌਕਰੀ ਲਈ ਐਗਜ਼ਾਮ ਦਿੱਤਾ ਜਾਂਦਾ ਹੈ ਇਵੇਂ ਕਿ ਸਰਕਾਰੀ ਨੌਕਰੀ ਲੈਣ ਉਪਰੰਤ ਮੇਰੀ ਇੱਛਾਵਾਂ ਵੀ ਹਨ ਜਿਹੜੀਆਂ ਕਿ ਮੈਂ ਹੌਲੀ ਹੌਲੀ ਪੂਰੀਆਂ ਕਰਾਂਗਾ ਅਤੇ ਸਰਕਾਰੀ ਨੌਕਰੀ ਦੇ ਵਿੱਚ ਵੀ ਮੈਂ ਉੱਚੇ ਪਦ ਉੱਤੇ ਜਾਣ ਦਾ ਇੱਛਕ ਹਾਂ ਅਤੇ ਨਾਲ ਹੀ ਨਾਲ ਮੇਰੀ ਇੱਛਾਵਾਂ ਇੱਕ ਬਿਜਨਸ ਬਰਨ ਕਰਨ ਦੀ ਵੀ ਹੈ ਜਿਵੇਂ ਕਿ ਮੈਂ ਬਰਗਰ ਬਰਗਰ ਸਟਾਲ ਦੀ ਅਤੇ ਕਾਫੀ ਹੋਰ ਬਿਜ਼ਨਸ ਹਨ ਮਨੀ ਟਰਾਂਸਫਰ ਇੱਦਾਂ ਦੇ ਬਿਜ਼ਨਸ ਮੈਂ ਕਰਨਾ ਚਾਹੁੰਦਾ ਅਤੇ ਨਾਲ ਹੀ ਕੁਝ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਦੇਣਾ ਚਾਹੁੰਦਾ ਅਤੇ ਮੇਰੀਆਂ ਇੱਛਾਵਾਂ ਹੈ ਕਿ ਜਿਹੜੀਆਂ ਕਿ ਮੈਂ ਆਪਣੇ ਮਾਂ ਪਿਓ ਦੇ ਨਾਲ ਇਹ ਸਰਕਾਰੀ ਨੌਕਰੀ ਦੇ ਵਿੱਚ ਰਹਿੰਦੇ ਰਹਿੰਦੇ ਪੂਰੀਆਂ ਕਰਨੀਆਂ ਚਾਹੁੰਦਾ ਮੈਂ ਆਪਣੇ ਜਿਵੇਂ ਕਿ ਟੂਰ ਹੁੰਦੇ ਅਕਸਰ ਰਾਜਸਥਾਨ ਦੈਲੀ ਆਗਰੇ ਵਿੱਚ ਘੁੰਮਣਾ ਚਾਹੁੰਦਾ ਦਰਬਾਰ ਸਾਹਿਬ ਮੱਥਾ ਟੇਕਣਾ ਚਾਹੁੰਦਾ ਅਤੇ ਹੋਰ ਵਧੀਆ ਵਧੀਆ ਜਗ੍ਹਾ ਜਿਵੇਂ ਮਲੇਸ਼ੀਆ ਇੰਡੋਨੇਸ਼ੀਆ ਜਿਵੇਂ ਕਿ ਭਾਰਤ ਦੇ ਵਿੱਚ ਸਟੇਟਾਂ ਹਨ ਉੱਥੇ ਸਾਰੀਆਂ ਸਟੇਟਾਂ ਦੇ ਵਿੱਚ ਮੈਂ ਘੁੰਮਣ ਦਾ ਇੱਛਾ ਇੱਛਾਵਾਂ ਮੇਰੀਆਂ ਅਤੇ ਮੈਂ ਆਪਣੇ ਬਲ ਬੁੱਤੇ ਨਾਲ ਇਹ ਪੂਰੀਆਂ ਕਰਨੀਆਂ ਚਾਹੁੰਦਾ ਮੇਰੇ ਟੀਚੇ ਅਤੇ ਇੱਛਾਵਾਂ ਇੱਕ ਦਿਨ ਜ਼ਰੂਰ ਪੂਰੀਆਂ ਹੋਣਗੀਆਂ